ਹੈਲੋ ਭਾਅ ਜੀ ਤੁਸੀਂ ਸੰਧੂ ਟਰੈਵਲ ਏਜੰਸੀ ਤੋਂ ਬੋਲ ਰਹੇ ਹਾਂ ਭਾਅ ਜੀ ਮੈਂ ਨਾ ਅੱਜ ਤੁਹਾਡੀ ਇੱਕ ਕੈਬ ਬੁੱਕ ਕੀਤੀ ਸੀ ਅਤੇ ਮੈਂ ਨਾ ਚੰਡੀਗੜ੍ਹ ਏਅਰਪੋਰਟ ਤੋਂ ਦੁਬਈ ਲਈ ਜਾਣਾ ਸੀ ਮੈਂ ਕੈਬ ਵਾਲੇ ਨੂੰ ਕਹਿ ਦਿੱਤਾ ਸੀ ਵੀ ਤੁਸੀਂ ਮੇਰੇ ਕੋਲ਼ ਕਰੈਕਟ ਨੌ ਵਜੇ ਪਹੁੰਚ ਜਾਉ ਜਦ ਕਿ ਮੇਰੀ ਗਿਆਰ੍ਹਾਂ ਵਜੇ ਦੀ ਫਲਾਈਟ ਸੀ ਪਹਿਲੀ ਤਾਂ ਗੱਲ ਹੈ ਉਹ ਨੌ ਵਜੇ ਦੀ ਬਜਾਏ ਮੇਰੇ ਕੋਲ ਸਾਢੇ ਨੌ ਵਜੇ ਪਹੁੰਚ ਰਿਹਾ ਉੱਪਰ ਤੋਂ ਜਦੋਂ ਅਸੀਂ ਰਾਹ 'ਚ ਗਏ ਤਾਂ ਮੈਂ ਟਾਈਮ ਸਿਰ ਏਅਰਪੋਰਟ 'ਤੇ ਨਹੀਂ ਪਹੁੰਚ ਸਕਿਆ ਅਤੇ ਮੇਰੀ ਫਲਾਈਟ ਮਿਸ ਹੋ ਗਈ ਅਤੇ ਪਹਿਲੀ ਤਾਂ ਗਲਤੀ ਤੁਹਾਡੀ ਇਦਾਂ ਹੈ ਵੀ ਤੁਹਾਡੇ ਡਰਾਈਵਰ ਕੋਈ ਸਮੇਂ ਦਾ ਪਾਬੰਦ ਨਹੀਂ ਉਹਦੇ ਵਿੱਚ ਕੋਈ ਰੂਲ ਰੈਗੂਲੇਸ਼ਨ ਕੋਈ ਫੋਲੋ ਨਹੀਂ ਤਾ ਕਰ ਰਿਹਾ ਉਹ ਅਤੇ ਨੰਬਰ ਦੂਜਾ ਉੱਪਰ ਤੋਂ ਉਹਦਾ ਵਿਵਹਾਰ ਵੀ ਕੋਈ ਵਧੀਆ ਨਹੀਂ ਸੀ ਅਤੇ ਮੈਂ ਇਹ ਹੀ ਚਾਹੁੰਦਾ ਕਿ ਹੁਣ ਉਹ ਮੇਰੇ ਤੋਂ ਕਿਰਾਇਆ ਮੰਗ ਰਿਹਾ ਸੀ ਅਤੇ ਮੈਂ ਹੁਣ ਉਹਨੂੰ ਕੋਈ ਕਿਰਾਇਆ ਨਹੀਂ ਦੇਣਾ ਕੋਈ ਕੁਛ ਨਹੀਂ ਦੇਣਾ ਜਦ ਕਿ ਉਹ ਹੁਣ ਮੇਰੀ ਜਿਹੜੀ ਫਲਾਈਟ ਮਿਸ ਹੋਈ ਹੈ ਵੀਹ ਹਜ਼ਾਰ ਰੁਪਏ ਦੀ ਟਿਕਟ ਸੀ ਮੇਰੀ ਦੁਬਈ ਜਾਣ ਦੀ ਅਤੇ ਉਹ ਉਹ ਵੀ ਭਰਪਾਈ ਹੁਣ ਤੁਸੀਂ ਕਰਕੇ ਦਿਓ ਕਿਉਂਕਿ ਉਹ ਮੇਰੇ ਕੋਲ ਸਮੇਂ ਸਿਰ ਨਹੀਂ ਪਹੁੰਚਿਆ ਤੇ ਮੈਂ ਉਹਨੂੰ ਕੋਈ ਹੁਣ ਕੋਈ ਕਿਰਾਇਆ ਨਹੀਂ ਦੇਣਾ ਕੋਈ ਕੁਛ ਨਹੀਂ ਦੇਣਾ ਅਤੇ ਉਲਟਾ ਤੁਹਾਡੇ ਉੱਪਰ ਤੁਹਾਡੀ ਕੰਪਨੀ ਉੱਪਰ ਮੈਂ ਕੇਸ ਕਰੂੰਗਾ ਜਿਸਦੀ ਵਜ੍ਹਾ ਨਾਲ ਮੈਨੂੰ ਇੰਨੀ ਹੈਰਾਨਗੀ ਇੰਨੀ ਪਰੇਸ਼ਾਨੀ ਹੋਈ ਜਦ ਕਿ ਮੇਰਾ ਉੱਥੇ ਜਾਣਾ ਦੁਬਈ ਜਾਣਾ ਬਹੁਤ ਜ਼ਿਆਦਾ ਜ਼ਰੂਰੀ ਸੀ ਅੱਜ ਮੈਂ ਬਹੁਤ ਜ਼ਰੂਰੀ ਕੰਮ ਨਾਲ ਉੱਥੇ ਜਾ ਰਿਹਾ ਸੀ ਪਰ ਤੁਹਾਡੇ ਡਰਾਈਵਰ ਨੇ ਅਜਿਹਾ ਕੰਮ ਕਰਿਆ ਕਿ ਉਹਨੇ ਮੈਨੂੰ ਇੰਨਾ ਲੇਟ ਕਰ ਦਿੱਤਾ ਮੈਂ ਹੁਣ ਬਹੁਤ ਪਰੇਸ਼ਾਨੀ ਵਿੱਚ ਹਾਂ ਜਦ ਕਿ ਤੁਹਾਡਾ ਡਰਾਈਵਰ ਮੈਨੂੰ ਬਾਰ ਬਾਰ ਹੁਣ ਕਹਿ ਰਿਹਾ ਕਿ ਮੈਨੂੰ ਮੇਰਾ ਕਿਰਾਇਆ ਦਿਓ ਮੈਂ ਕਿਰਾਇਆ ਦਿਓ ਮੈਂ ਕੋਈ ਕਿਰਾਇਆ ਨਹੀਂ ਦੇਣਾ ਜੀ ਹੁਣ ਤੁਹਾਡੇ 'ਤੇ ਉਤਾ ਉਲਟਾ ਕੇਸ ਕਰਨਾ